ਅੰਮ੍ਰਿਤਸਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਉਤਪਾਦ ਕਣਕ ਅਤੇ ਝੋਨਾ ਹੈ ਇਸ ਤੋਂ ਇਲਾਵਾ ਜਦੋਂ ਅਸੀਂ ਸਰਦੀਆਂ ਦੇ ਮੌਸਮ ਵਿੱਚ ਕਣਕ ਦੀ ਬਿਜਾਈ ਕਰਦੇ ਹਾਂ ਤਾਂ ਉਸਦੀ ਵਾਢੀ ਵਿਸਾਖੀ ਲਾਗੇ ਹੋ ਜਾਂਦੀ ਹੈ ਕਣਕ ਦੀ ਵਾਢੀ ਤੋਂ ਬਾਅਦ ਲਗਭਗ ਡੇਢ ਮਹੀਨਾ ਬਚਦਾ ਹੈ ਜਦੋਂ ਝੋਨੇ ਦੀ ਪਨੀਰੀ ਲਗਾਈ ਜਾਂਦੀ ਹੈ ਅਤੇ ਝੋਨਾ ਦਸ ਜੂਨ ਦੇ ਲਾਗੇ ਲਗਾਇਆ ਜਾਂਦਾ ਹੈ ਇਸ ਸਮੇਂ ਦੌਰਾਨ ਆਲੂ ਦੀ ਫਸਲ ਹੋ ਜਾਂਦੀ ਹੈ ਆਲੂ ਸਬਜ਼ੀ ਦੇ ਤੌਰ 'ਤੇ ਉਗਾ ਲੈਂਦੇ ਹਾਂ ਅਤੇ ਉਸ ਤੋਂ ਬਾਅਦ 'ਚ ਜਦੋਂ ਝੋਨਾ ਲੱਗਦਾ ਹੈ ਤਾਂ ਝੋਨਾ ਦੀ ਬਿਜਾਈ ਤੋਂ ਬਾਅਦ ਕਟਾਈ ਅਤੇ ਕਟਾਈ ਤੋਂ ਬਾਅਦ ਕਣਕ ਲਗਾਉਣ ਦੇ ਵਿੱਚ ਜਿਹੜਾ ਸਮਾਂ ਬਚਦਾ ਹੈ ਉਦੋਂ ਮਟਰ ਜਿਹੜੇ ਉਗਾ ਲਏ ਜਾਂਦੇ ਹਨ ਇਸ ਤੋਂ ਇਲਾਵਾ ਜਿਹੜਾ ਦੂਸਰਾ ਮੁੱਖ ਧੰਦਾ ਹੈ ਉਹ ਹੈ ਪਸ਼ੂ ਧਨ ਜਾਂ ਪਸ਼ੂ ਪਾਲਣ ਦਾ ਧੰਦਾ ਜਿਸ ਦੇ ਵਿੱਚ ਮੱਝਾਂ ਗਾਵਾਂ ਭੇਡਾਂ ਬੱਕਰੀਆਂ ਅਤੇ ਪੋਲਟਰੀ ਇਹ ਸਭ ਇੱਥੇ ਪਾਲੇ ਜਾਂਦੇ ਹਨ ਮੱਝਾਂ ਅੰਮ੍ਰਿਤਸਰ ਦੇ ਵਿੱਚ ਦੋ ਨਸਲਾਂ ਨੇ ਮੱਝਾਂ ਦੀਆਂ ਨੀਲੀ ਰਾਵੀ ਅਤੇ ਮੋਰਾ ਨੀਲੀ ਰਾਵੀ ਜਿਸ ਨੂੰ ਪੰਜ ਕੁਲੈਹਣੀ ਵੀ ਕਿਹਾ ਜਾਂਦਾ ਹੈ ਇੱਥੋਂ ਦੀ ਨੇਟਿਵ ਮੱਝ ਹੋਣ ਕਰਕੇ ਘੱਟ ਖਰਚੇ 'ਤੇ ਵੱਧ ਦੁੱਧ ਦਿੰਦੀ ਹੈ ਜਿੰਨਾ ਅਸੀਂ ਸਤਲੁਜ ਤੋਂ ਬਾਹਰ ਚੱਲ ਚੱਲਦੇ ਹਾਂ ਮੋਰਾ ਉੱਧਰਲੇ ਪਾਸੇ ਜ਼ਿਆਦਾ ਵਧੀਆ ਪ੍ਰੋਡਕਸ਼ਨ ਦਿੰਦੀ ਹੈ ਪਰ ਨੀਲੀ ਰਾਵੀ ਇਸ ਏਰੀਏ ਦੀ ਮੱਝ ਹੋਣ ਕਰਕੇ ਲੋਕਾਂ ਨੂੰ ਜ਼ਿਆਦਾ ਫ਼ਾਇਦਾ ਦਿੰਦੀ ਹੈ ਭੇਡਾਂ ਬੱਕਰੀਆਂ ਦੀ ਵੀ ਬਹੁਤ ਗਿਣਤੀ ਹੈ ਇਸ ਸ਼ਹਿ ਸ਼ਹਿਰ ਦੇ ਵਿੱਚ ਅਤੇ ਪੋਲਟਰੀ ਫਾਰਮ ਵੀ ਬਹੁਤ ਸਾਰੇ ਖੁੱਲੇ ਹਨ ਇਹ ਸਾਰੇ ਦੇ ਸਾਰੇ ਅ ਅੰਮ੍ਰਿਤਸਰ ਦੀ ਜੀ ਡੀ ਪੀ ਦੇ ਵਿੱਚ ਕਾਫ਼ੀ ਵਧੀਆ ਰੋਲ ਅਦਾ ਕਰਦੇ ਹਨ ਅਤੇ ਕਰੀਬ ਅੰਮ੍ਰਿਤਸਰ ਦੇ ਵਿੱਚ ਚਾਰ ਲੱਖ ਮੱਝਾਂ ਅਤੇ ਗਾਵਾਂ ਦੀ ਪਾਪੂਲੇਸ਼ਨ ਹੈ